ਹਾਂਜੀ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਸਤੇ ਮੁਸ਼ਕਲਾਂ ਤਾਂ ਫੇਸ ਕਰਨੀਆਂ ਹੀ ਪੈਂਦੀਆਂ ਨੇ ਕਿਸੇ ਵੀ ਕੰਮ ਨੂੰ ਇਸਟੈਬਲਿਸ਼ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਲੋਕੇਸ਼ਨ ਦਾ ਬਹੁਤ ਧਿਆਨ ਰੱਖਣਾ ਪੈਂਦਾ ਉਹ ਸਭ ਤੋਂ ਵੱਡੀ ਇੱਕ ਪ੍ਰੋਬਲਮ ਆਪਾਂ ਕਹਿ ਸਕਦੇ ਹਾਂ ਕਿਉਂਕਿ ਸਾਡਾ ਅਗਰ ਕਾਰੋਬਾਰ ਇਕ ਅੱਛੀ ਲੋਕੇਸ਼ਨ ਦੇ ਵਿੱਚ ਹੈ ਤਾਂ ਹੀ ਅਸੀਂ ਆਪਣੇ ਕੰਮ ਦੀ ਉਮੀਦ ਲਗਾ ਸਕਦੇ ਹਾਂ ਕਿ ਕੱਲ੍ਹ ਨੂੰ ਸਾਨੂੰ ਉਸ ਚੀਜ਼ ਦੇ ਵਿੱਚ ਫਾਇਦਾ ਮਿਲੇਗਾ ਸੈਕਿੰਡਲੀ ਫਾਈਨੈਂਸ਼ਅਲੀ ਵੀ ਆਪਾਂ ਨੂੰ ਦੇਖ ਕੇ ਚੱਲਣਾ ਪੈਂਦਾ ਕਿ ਬਿਜਨਸ ਦੇ ਵਿੱਚ ਅਗਰ ਅਸੀਂ ਪੈਸੇ ਖਰਚ ਕਰਦੇ ਹਾਂ ਤਾਂ ਉਹ ਸੋਚ ਕੇ ਹੀ ਕਰਨੇ ਪੈਂਦੇ ਨੇ ਕਿ ਕਿਸ ਹੱਦ ਤੱਕ ਅਸੀਂ ਆਪਣੇ ਬਿਜਨਸ ਨੂੰ ਸ਼ੁਰੂ ਤੋਂ ਹੀ ਸਟਾਰਟ ਕਰੀਏ ਇੱਕਦਮ ਪੈਸਾ ਲਗਾਉਣਾ ਵੀ ਸਾਡੀ ਮੁਸ਼ਕਲ ਬਣ ਸਕਦੀ ਹੈ ਕਿਉਂਕਿ ਬਿਜਨਸ ਅਗਰ ਨਾ ਚੱਲਿਆ ਤਾਂ ਸਾਡਾ ਪੈਸਾ ਖਰਾਬ ਹੋ ਸਕਦਾ ਹੈ